ਯੋਗ ਇੱਕ ਪ੍ਰਾਚੀਨ ਭਾਰਤੀ ਵਿਗਿਆਨ ਹੈ ਜੋ ਸਰੀਰ ਮਨ ਅਤੇ ਆਤਮਾ ਦਾ ਸਹਾਰਾ ਕਰਦਾ ਹੈ ਇਸ ਵਿੱਚ ਵੱਖ ਵੱਖ ਆਸਣ ਅਤੇ ਪੈਨਾਯਾਮ ਸ਼ਾਮਿਲ ਹੁੰਦੇ ਹਨ ਜੋ ਮਨੁੱਖ ਦੇ ਸਰੀਰ ਨੂੰ ਅਤੇ ਮਨ ਨੂੰ ਸ਼ਾਂਤੀ ਅਤੇ ਸ਼ਕਤੀ ਦਿੰਦੇ ਹਨ ਯੋਗ ਕਰਨ ਦੇ ਨਾਲ ਮਨੁੱਖ ਦਾ ਸ਼ ਮਨੁੱਖ ਦਾ ਸਰੀਰ ਨਿਰੋਗ ਰਹਿੰਦਾ ਹੈ ਇਸ ਦੇ ਨਾਲ ਕਾਫੀ ਪ੍ਰਭਾਵ ਪੈਂਦੇ ਹਨ ਮਨ ਨੂੰ ਸਿਹਤ 'ਤੇ ਪ੍ਰਭਾਵ ਕੀ ਪੈਂਦਾ ਹੈ ਜਾਂ ਕਿਸ ਪ੍ਰਕਾਰ ਹੈ ਸ਼ਾਂਤੀ ਯੋਗ ਦੇ ਨਿੱਤ ਅਭਿਆਸ ਨਾਲ ਮਨ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਧਿਆਨ ਅਤੇ ਸਾਹਸ ਕਸਰਤ ਦੇ ਜ਼ਰੀਏ ਤਣਾਅ ਅਤੇ ਚਿੰਤਾ ਤੋਂ ਮੁਕਤੀ ਮਿਲਦੀ ਹੈ ਯੋਗ ਕਰਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਵਿਚਾਰ ਸਾਫ ਹੋ ਜਾਂਦੇ ਹਨ ਦੂਜਾ ਹੈ ਭਾਵਨਾ ਸੁਧਾਰ ਯੋਗ ਕਰਨ ਨਾਲ ਭਾਵਨਾ ਸਥਿਰ ਰਹਿੰਦੀ ਹੈ ਇਸ ਨਾਲ ਮਨੁੱਖ ਜ਼ਿਆਦਾ ਖੁਸ਼ੀ ਮਹਿਸੂਸ ਕਰਦਾ ਹੈ ਅਤੇ ਦੁੱਖ ਦਰਦ ਨਾਲ ਨਜਿੱਠਣ ਦੀ ਯੋਗਤਾ ਵੱਧਦੀ ਹੈ ਯੋਗ ਦੇ ਅਭਿਆਸ ਨਾਲ ਮਨੁੱਖ ਨੂੰ ਗੁੱਸੇ ਡਰ ਅਤੇ ਤਣਾਅ 'ਤੇ ਕੰਟਰੋਲ ਮਿਲਦਾ ਹੈ ਹੁਣ ਹੈ ਸਰੀਰਕ ਸਰੀਰਕ ਸਿਹਤ 'ਤੇ ਪ੍ਰਭਾਵ ਕੀ ਪੈਂਦਾ ਹੈ ਪਹਿਲਾ ਹੈ ਸਕਤੀ ਅਤੇ ਸਟੈਮੀਨਾ ਯੋਗ ਦੇ ਨਿੱਤ ਅਭਿਆਸ ਨਾਲ ਸਰੀਰ ਵਿੱਚ ਸ਼ਕਤੀ ਅਤੇ ਸਟੈਮੀਨਾ ਵੱਧਦਾ ਹੈ ਇਹ ਸਰੀਰ ਦੇ ਪੱਟਿਆਂ ਨੂੰ ਮਜ਼ਬੂਤ ਅਤੇ ਲਚਕੀਲਾ ਬਣਾਉਂਦਾ ਹੈ ਇਸ ਨਾਲ ਦਿਨ ਪ੍ਰਤੀ ਥਕਾਵਟ ਦੂਰ ਰਹਿੰਦੀ ਹੈ ਅਤੇ ਕੰਮ ਕਰਨ ਦੀ ਯੋਗਤਾ ਵੱਧਦੀ ਹੈ ਦੂਜਾ ਹੈ ਸਰੀਰ ਦੀ ਸਰੀਰਕ ਸਿਹਤ ਜੋ ਕਿ ਸਰੀਰ ਦੀ ਸਿਹਤ ਲਈ ਬਹੁਤ ਲਾਭਕਾਰੀ ਇਸ ਨਾਲ ਸਰੀਰ ਦੇ ਵੱਖ ਵੱਖ ਹਿਸਿਆਂ ਵਿੱਚ ਲਚਕ ਅਤੇ ਮਜ਼ਬੂਤੀ ਆਉਂਦੀ ਹੈ ਯੋਗ ਕਰਨ ਨਾਲ ਹਾਰਟ ਦੀ ਸਿਹਤ ਚੰਗੀ ਰਹਿੰਦੀ ਹੈ ਅਤੇ ਬਿਮਾਰੀਆਂ ਤੋਂ ਬਚਾ ਹੁੰਦਾ ਹੈ ਜਿਹੜੇ ਬੰਦੇ ਹਾਰਟ ਦੇ ਮਰੀਜ਼ ਹਨ ਉਹਨਾਂ ਨੂੰ ਤਾਂ ਯੋਗ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਉਹਨਾਂ ਨੂੰ ਉਹ ਬਿਮਾਰੀ ਤੋਂ ਮੁਕਤ ਰਹਿੰਦੇ ਹਨ ਯੋਗ ਕਰਨ ਨਾਲ ਕੋਈ ਵੀ ਬਿਮਾਰੀ ਆਪਾਂ ਨੂੰ ਹੋ ਨਹੀਂ ਸਕਦੀ ਫਿਰ ਇਹ ਸਮਾਜਿਕ ਅਤੇ ਰੋਜ਼ਾਨਾ ਜੀਵਨ ਦੇ ਪ੍ਰਭਾਵ ਰਿਸ਼ਤੇ ਅਤੇ ਸਮਾਜਿਕ ਜੀਵਨ ਯੋਗ ਕਰਨ ਨਾਲ ਮਨੁੱਖ ਦੇ ਰਿਸ਼ਤੇ ਵੀ ਸੁਧਰਦੇ ਹਨ ਸ਼ਾਂਤ ਅਤੇ ਸਥਿਰ ਮਨ ਨਾਲ ਮਨੁੱਖ ਹੋਰਨਾ ਨਾਲ ਚੰਗੇ ਸੰਬੰਧ ਬਣਾ ਸਕਦਾ ਹੈ ਅਤੇ ਸਮਾਜਿਕ ਜੀਵਨ ਵਿੱਚ ਸੁਖੀ ਰਹਿੰਦਾ ਹੈ ਦੂਜਾ ਹੈ ਰੋਜ਼ਾਨਾ ਕਾਰਜ ਯੋਗ ਕਰਨ ਨਾਲ ਰੋਜ਼ਾਨਾ ਦੇ ਕਾਰਜਾਂ ਵਿੱਚ ਵੀ ਸੁਧਾਰ ਆਉਂਦਾ ਹੈ ਇਸ ਨਾਲ ਮਨੁੱਖ ਜ਼ਿਆਦਾ ਚੁਸਤ ਰਹਿੰਦਾ ਹੈ ਅਤੇ ਹਰ ਕੰਮ ਨੂੰ ਚੰਗੇ ਤਰੀਕੇ ਨਾਲ ਕਰ ਸਕਦਾ ਹੈ ਸਾਰਿਆਂ ਨਾਲੋਂ ਵੱਡਾ ਪ੍ਰਭਾਵ ਤਾਂ ਆਪਣੇ ਸਰੀਰ 'ਤੇ ਇਹ ਪੈਂਦਾ ਹੈ ਕਿ ਅਗਰ ਆਪਾਂ ਰੋਜ਼ਾਨਾ ਯੋਗ ਕਰਦੇ ਹਾਂ ਤਾਂ ਆਪਾਂ ਬਿਲਕੁਲ ਸਵਸਥ ਅਤੇ ਨਿਰੋਗ ਰਹਿ ਸਕਦੇ ਹਾਂ ਜਿਹੜੇ ਬੰਦੇ ਬਿਮਾਰੀਆਂ ਦਾ ਸ਼ਿਕਾਰ ਬਹੁਤ ਜਲਦੀ ਹੋ ਜਾਂਦੇ ਹਨ ਉਹਨਾਂ ਨੂੰ ਤਾਂ ਯੋਗ ਕਰਨਾ ਬਹੁਤ ਹੀ ਜ਼ਰੂਰੀ ਹੈ ਯੋਗ ਦਾ ਅਭਿਆਸ ਕਰਨ ਨਾਲ ਮਨੁੱਖ ਦੇ ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਵੱਡਾ ਸੁਧਾਰ ਆਉਂਦਾ ਹੈ ਇਹ ਸਿਰਫ ਸ਼ਕਤੀ ਅਤੇ ਸਟੈਮੀਨਾ ਹੀ ਨਹੀਂ ਬਲਕਿ ਸ਼ਾਂਤੀ ਖੁਸ਼ੀ ਅਤੇ ਭਾਵਨਾ ਸੁਧਾਰ ਵੀ ਲਿਆਉਂਦਾ ਹੈ